ਮੌਨਸੂਨ ਸੀਜ਼ਨ ਇੱਕ ਬਹੁਤ ਹੀ ਵਧੀਆ ਅਤੇ ਘਟੀਆ ਸੀਜ਼ਨ ਹੈ ਕੁਝ ਲੋਕਾਂ ਲਈ ਇਹ ਬਹੁਤ ਹੀ ਜ਼ਿਆਦਾ ਵਧੀਆ ਅਤੇ ਕੁਝ ਲੋਕਾਂ ਲਈ ਬਹੁਤ ਜ਼ਿਆਦਾ ਘਟੀਆ ਹੈ ਇਸ ਨੂੰ ਆਪਾਂ ਇਸ ਤਰ੍ਹਾਂ ਦੇਖ ਸਕਦੇ ਹੈ ਕਿ ਜਿਹੜੇ ਕਿਸਾਨ ਲੋਕ ਹਨ ਉਹ ਖੇਤ ਨੂੰ ਪਾਣੀ ਲਾਉਣਾ ਚਾਹੁੰਦੇ ਹਨ ਅਤੇ ਜੇ ਕੀ ਮਾਤਰਾ ਵਿੱਚ ਪਾਣੀ ਆਏ ਤਾਂ ਬਹੁਤ ਹੀ ਵਧੀਆ ਪਰ ਜੇ ਵੱਧ ਮਾਤਰਾ ਵਿੱਚ ਪਾਣੀ ਆ ਜੇ ਤਾਂ ਉਹਨਾਂ ਦੀ ਫਸਲ ਹੀ ਖਰਾਬ ਹੋ ਜਾਂਦੀ ਹੈ ਅਤੇ ਕੋਈ ਪੈਸਾ ਨਹੀਂ ਕਮਾ ਪਾਉਂਦੇ ਮੌਨਸੂਨ ਸੀਜ਼ਨ ਆਉਣ ਨਾਲ ਇਹ ਵੀ ਹੈ ਕਿ ਜੇ ਠੰਡ ਹੋਵੇ ਠੰਡ ਚੁੱਕ ਹੋ ਜਾਂਦੀ ਹੈ ਗਰਮੀ ਹੋਵੇ ਤਾਂ ਗਰਮੀ ਚੁੱਕ ਹੋ ਜਾਂਦੀ ਹੈ ਮੌਨਸੂਨ ਸੀਜ਼ਨ ਆਉਣ ਨਾਲ ਖੁਸ਼ਹਾਲੀ ਵੀ ਆਉਂਦੀ ਹੈ ਅਤੇ ਦੁਖਹਾਲੀ ਵੀ ਕਿਉਂਕਿ ਖੁਸ਼ਹਾਲੀ ਇਸ ਤਰ੍ਹਾਂ ਕਿ ਜਿੱਥੇ ਗਰਮੀ ਹੁੰਦੀ ਹੈ ਉੱਥੇ ਠੰਡ ਹੋਣ ਲੱਗ ਪੈਂਦੀ ਹੈ ਅਤੇ ਦੁੱਖ ਇਸ ਲਈ ਤਾਂ ਕਿ ਕਈ ਜਗ੍ਹਾ ਵਾੜ ਵੁੜ ਵੀ ਆ ਜਾਂਦੀ ਹੈ ਅਤੇ ਲੋਕਾਂ ਦੇ ਘਰ ਸੰਪਤੀ ਸਭ ਕੁਝ ਰੁੜ ਜਾਂਦਾ ਹੈ ਬਾਕੀ ਹਰ ਚੀਜ਼ ਮਾਤਰਾ ਵਿੱਚ ਹੀ ਰਹੇ ਤਾਂ ਵਧੀਆ ਹੁੰਦੀ ਹੈ ਕੋਈ ਚੀਜ਼ ਵੀ ਵੱਧ ਜਾਵੇ ਤਾਂ ਉਹ ਨੁਕਸਾਨ ਹੀ ਹੁੰਦੀ ਹੈ ਸਾਡੇ ਇੱਥੇ ਮੌਨਸੂਨ ਸੀਜ਼ਨ ਲਗਭਗ ਲਗਭਗ ਅਪ੍ਰੈਲ ਮਈ ਦੇ ਲਾਗੇ ਛਾਗੇ ਹੀ ਆਉਂਦਾ ਹੈ ਅਤੇ ਜਦੋਂ ਆਉਂਦਾ ਹੈ ਖੁਸ਼ਹਾਲੀ ਦੇ ਨਾਲ ਨਾਲ ਥੋੜ੍ਹੇ ਬਹੁਤ ਦੁੱਖ ਵੀ ਲਿਆਉਂਦਾ ਹੈ ਖੁਸ਼ਹਾਲੀ ਇਸ ਕਰਕੇ ਕਿ ਲੋਕ ਪਾਣੀ ਪੂਣੀ ਮਿਲ ਜਾਂਦਾ ਹੈ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ ਡੈਮ ਵਗੈਰਾ ਭਰ ਜਾਂਦੇ ਨੇ ਦੁਖਹਾਲੀ ਇਸ ਕਰਕੇ ਤੇ ਜੇ ਵੱਧ ਤੋਂ ਵੱਧ ਮੌਨਸੂਨ ਆ ਜੇ ਤਾਂ ਫਿਰ ਸਭ ਕੁਝ ਰੁੜ ਜਾਂਦਾ ਹੈ ਸੰਪਤੀ ਲੋਕ ਖੇਤ ਜ਼ਿਆਦਾਤਰ ਨੁਕਸਾਨ ਵੱਧ ਮੌਨਸੂਨ ਦਾ ਕਿਸਾਨਾਂ ਨੂੰ ਹੀ ਹੁੰਦਾ ਹੈ ਕਿਉਂਕਿ ਪਾਣੀ ਜ਼ਿਆਦਾ ਆਉਣ ਨਾਲ ਉਹਨਾਂ ਦੇ ਖੇਤ ਵਗੈਰਾ ਸਭ ਖਰਾਬ ਹੋ ਜਾਂਦੇ ਹਨ ਉਹਨਾਂ ਦੀ ਛੇ ਛੇ ਮਹੀਨਿਆਂ ਦੀ ਮਿਹਨਤਾਂ ਖਰਾਬ ਹੋ ਜਾਂਦੀਆਂ ਹਨ ਬਾਕੀ ਮੌਨਸੂਨ ਸੀਜ਼ਨ ਇੱਕ ਵਧੀਆ ਸੀਜ਼ਨ ਹੈ